ਮੋਹਾਲੀ ਜ਼ਿਲ੍ਹਾ ਆਪਣੇ ਆਪ 'ਚ ਹੀ ਇੱਕ ਬਹੁਤ ਵੱਡਾ ਜ਼ਿਲ੍ਹਾ ਹੈ ਜਿੱਥੇ ਕਿ ਰੋਜ਼ੀ ਰੋਟੀ ਦੇ ਬਹੁਤ ਹੀ ਸ੍ਰੋਤ ਹਨ ਲੋਕ ਖੁਦ ਖੇਤੀਬਾੜੀਆਂ ਕਰਦੇ ਹਨ ਅਤੇ ਖੁਦ ਫੈਕਟਰੀਆਂ 'ਚ ਕੰਮ ਕਰਦੇ ਹਨ ਫੂਡ ਪੈਕ ਕਰਦੇ ਹਨ ਸਭ ਕੁਛ ਕਰਦੇ ਹਨ ਅਤੇ ਇੱਥੇ ਬਹੁਤ ਹੀ ਸਰਕਾਰੀ ਨੌਕਰੀਆਂ ਅਤੇ ਪ੍ਰਾਈਵੇਟ ਨੌਕਰੀਆਂ ਵੀ ਹਨ ਬਟ ਜੋ ਵੀ ਸਾਡੇ ਏਰੀਏ ਦੇ ਲੋਕਾਂ ਨੂੰ ਨਹੀਂ ਮਿਲਦੀਆਂ ਅਤੇ ਬੇਰੁਜ਼ਗਾਰੀ ਦਾ ਸਪੈਸ਼ਲੀ ਸਾਡੇ ਮੋਹਾਲੀ ਜ਼ਿਲ੍ਹੇ 'ਚ ਬਹੁਤ ਜ਼ਿਆਦਾ ਫੈਲੀ ਹੋਈ ਆ ਕਿਉਂਕਿ ਲੋਕ ਬਾਹਰ ਵੱਲ ਨੂੰ ਜ਼ਿਆਦਾ ਭੱਜ ਰਹੇ ਹੁਣ ਕਿਉਂਕਿ ਇੱਥੇ ਜੋ ਵੀ ਇੱਥੇ ਸੈਲਰੀਜ਼ ਮਿਲ ਰਹੀਆਂ ਹਨ ਉਹ ਉਹਨਾਂ 'ਚ ਸੈਟੀਸਫਾਈਡ ਨਹੀਂ ਹੈਗੇ ਉਹਨਾਂ ਦੇ ਜਿਹੜੇ ਡੇਲੀ ਦੇ ਸ੍ਰੋਤ ਹਨ ਉਹ ਨਹੀਂ ਪੂਰੇ ਹੋ ਰਹੇ ਨਾ ਖਾਣ ਪੀਣ ਦਾ ਨਾ ਕੁਛ ਹੋਰ ਅਤੇ ਮੋਹਾਲੀ ਜ਼ਿਲ੍ਹੇ 'ਚ ਖੇਤੀਬਾੜੀ ਬਹੁਤ ਹੀ ਜ਼ਿਆਦਾ ਆ ਆਲ਼ੇ ਦੁਆਲੇ ਦੇ ਜ਼ਿਲ੍ਹਿਆਂ ਵਿੱਚ ਕਿ ਪਿੰਡਾਂ ਵਿੱਚ ਬਹੁਤ ਹੀ ਸਾਧਨ ਹਨ ਖੇਤੀਬਾੜੀ ਦੇ ਬਟ ਕਮਾਈ ਨਾ ਹੋਣ ਕਰਕੇ ਲੋਕ ਖੇਤੀਬਾੜੀ ਵੀ ਬਹੁਤ ਹੀ ਘਟਾਉਂਦੇ ਜਾ ਰਹੇ ਹਨ ਕਿਉਂਕਿ ਉਹਨਾਂ ਨੂੰ ਕੁਛ ਅ ਫਾਇਦਾ ਦਿਖ ਹੀ ਨਹੀਂ ਰਿਹਾ ਉਹ ਚੀਜ਼ਾਂ 'ਚ ਵੀ ਅਤੇ ਸਰਕਾਰ ਨੂੰ ਇਹ ਚੀਜ਼ ਦੀ ਅਪੀਲ ਕੀਤੀ ਜਾਂਦੀ ਆ ਵੀ ਘੱਟੋ ਘੱਟ ਉਹਨਾਂ ਦੇ ਜਿਹੜੇ ਬਣਦੀ ਆ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਦਿੱਤੀ ਜਾਵੇ ਅਤੇ ਸਰਕਾਰੀ ਨੌਕਰੀਆਂ ਜਿੰਨੀਆਂ ਹੋਣ ਉਹ ਕੱਢੀਆਂ ਜਾਣ ਤਾਂ ਕਿ ਬੱਚੇ ਆਪਣੇ ਪੇਰੈਂਟਸ ਕੋਲ ਰਹਿ ਕੇ ਖੁਦ ਜਿੰਨਾ ਕੁ ਹੈ ਉਨਾਂ ਕਮਾ ਕੇ ਆਪਣੇ ਡੇਲੀ ਦੇ ਸ੍ਰੋਤ ਪੂਰੇ ਕਰ ਸਕਣ